ਹੈਲੋ ਹਾਂਜੀ ਜੀ ਟਰੈਵਲ ਏਜ ਗੱਲ ਕਰ ਰਹੇ ਹਾਂਜੀ ਕਿੱਥੋਂ ਜਾਣਾ ਤੁਸੀਂ ਅੱਛਾ ਠੀਕ ਐ ਜੀ ਵੈਸੇ ਤਾਂ ਵੀਹ ਹਜ਼ਾਰ ਪਰ ਪਰਸਨ ਐ ਅਸੀਂ ਤੁਹਾਨੂੰ ਹੋਟਲ ਨਾਲੇ ਵਿੱਚ ਹੀ ਫਿਜੀ ਵਗੈਰਾ ਹੋਣਗੇ ਬ੍ਰੇਕਫਾਸਟ ਲੰਚ ਡਿਨਰ ਪਰ ਤੁਹਾਨੂੰ ਟਰਾਂਸਪੋਰਟੇਸ਼ਨ ਕੋਰਸ ਤੁਹਾਡੀ ਹੋਏਗੀ ਸਾਰੀ ਹਾਂਜੀ ਜੀ ਇਹ ਬ੍ਰੇਕਫਾਸਟ ਲੰਚ ਤੇ ਡਿਨਰ ਤਿੰਨ ਹੋਣਗੇ ਤੁਹਾਡੇ ਨਹੀਂ ਜੀ ਨਹੀਂ ਜੀ ਜੇ ਕੋਈ ਮਨ ਜਾਣਾ ਤੇ ਫਿਰ ਤੁਹਾਨੂੰ ਆਪ ਹੀ ਜਾਣਾ ਪਏਗਾ ਆ ਬੱਚਿਆਂ ਦੀ ਏਜ ਕਿੰਨੀ ਹੈ ਜੀ ਅੱਛਾ ਵੈਸੇ ਅਸੀਂ ਦਸ ਸਾਲ ਤੋਂ ਛੋਟੇ ਬੱਚੇ ਵਾਸਤੇ ਰੱਖਣੇ ਡਿਸਕਾਊਂਟ ਪਰ ਕੋਈ ਗੱਲ ਨਹੀਂ ਜੇ ਤੁਸੀਂ ਕਿੰਨੇ ਮੈਂਬਰ ਹੋ ਵੈਸੇ ਅੱਛਾ ਤੇ ਹਸਬੈਂਡ ਦੀ ਏਜ ਕਿੰਨੀ ਐ ਜੀ ਅੱਛਾ ਤੋ ਤੁਹਾਡੀ ਠੀਕ ਹੈ ਕੋਈ ਨਾ ਥਨੂੰ ਡਿਸਕਾਊਂਟ ਦੇ ਦਾਂਗੇ ਜੀ ਅਸੀਂ ਤਾਂ ਜੀ ਹਮੇਸ਼ਾ ਤੁਹਾਡੇ ਨਾਲ ਜਿੰਨੀ ਦੇਰ ਤੱਕ ਤੁਸੀਂ ਟੂਰ ਕਰੋਗੇ ਅਸੀਂ ਤੁਹਾਡੇ ਨਾਲ ਟਰੈਵਲਿੰਗ ਬਣ ਕੇ ਰਵਾਂਗੇ ਨਹੀਂ ਜੀ ਉਹ ਇੱਕ ਅੱਛਾ ਹੀ ਹੈ ਸਾਰਾ ਹਾਂਜੀ ਹਾਂ ਹਾਂਜੀ ਜੀ ਬੇਫਿਕਰ ਰਹੋ ਤੁਹਾਨੂੰ ਸਭ ਵਧੀਆ ਫੈਸਲਿਟੀਜ਼ ਮਿਲਾ ਨਹੀਂ ਗਿਆ ਹਾਂਜੀ ਨਾ ਕਦੋਂ ਐ ਜੀ ਡੇਟ ਤੁਹਾਡਾ ਅਕਤੂਬਰ ਤੋਂ ਲੈ ਕੇ ਕਿੰਨੇ ਦੇਰ ਤੱਕ ਠੀਕ ਐ ਤੇ ਨਾਲੇ ਤੁਹਾਨੂੰ ਤੁਸੀਂ ਬਸ ਨਾ ਇਹ ਡੈਸਟੀਨੇਸ਼ਨ ਸਾਨੂੰ ਦੱਸਦੇ ਤੁਸੀਂ ਕਿੱਥੋਂ ਜਾਣਾ ਅਸੀਂ ਤੁਹਾਨੂੰ ਉਥੇ ਵੀ ਕਰ ਲਾਂਗੇ ਠੀਕ ਐ ਜੀ